ਹਾਂਜੀ ਮੈਂ ਨਵਾਂ ਕੁਝ ਸਿੱਖਣ ਦਾ ਸਿੱਖਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਂਕ ਹੈ ਅਤੇ ਮੈਂ ਹੁਣ ਕੇਕ ਬਣਾਉਣਾ ਸਿੱਖਿਆ ਹੈ ਜੋ ਕਿ ਚੋਕਲੇਟ ਕੇਕ ਅਲੱਗ ਅਲੱਗ ਤਰ੍ਹਾਂ ਦੇ ਪਾਇਨੈਪਲ ਕੇਕ ਮੈਨੂੰ ਬਣਾਉਣ ਦਾ ਬੜਾ ਸ਼ੌਂਕ ਸੀ ਅਤੇ ਮੈਂ ਉਹ ਬਹੁਤ ਸਿੱਖਿਆ ਮੈਨੂੰ ਬਹੁਤ ਵਧੀਆ ਲੱਗਿਆ ਅਤੇ ਆਪਾਂ ਜਿਹੜਾ ਉਹਨਾਂ ਵਿੱਚ ਪਤਾ ਲੱਗਿਆ ਹੈ ਕਿਸ ਚੀਜ਼ ਵਿੱਚ ਮੋਟਾਪਾ ਹੁੰਦਾ ਕਿਸ ਵਿਚ ਨਹੀਂ ਹੁੰਦਾ ਅਤੇ ਕੇਕ ਬਣਾਉਣ ਦੀਆਂ ਕਲਾਸਾਂ ਮੈਂ ਆਪਣੀਆਂ ਕੁਛ ਯੂਟਿਊਬ 'ਤੇ ਸਿੱਖੀਆਂ ਕੁਛ ਮੈਂ ਬਾਹਰ ਆਪਣੀਆਂ ਲਗਾਈਆਂ ਅਤੇ ਮੈਨੂੰ ਬਣਾਉਣ ਦਾ ਬੜਾ ਸ਼ੌਂਕ ਹੈ ਅਤੇ ਉਹ ਬਹੁਤ ਵਧੀਆ ਹੈ